ਬਾਈਕਿੰਗ ਦੁਆਰਾ ਸਥਾਨਕ ਅਰਥ ਵਿਵਸਥਾ ਨੂੰ ਕਿਵੇਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਬਾਈਕਿੰਗ ਦੁਆਰਾ ਸਥਾਨਕ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਤਰੀਕੇ ਇਹ ਹਨ ਕਿ ਅਸੀਂ ਜਦੋਂ ਆਪਣੇ ਸ਼ਹਿਰ ਤੋਂ ਕਿਸੇ ਦੂਸਰੀ ਜਗ੍ਹਾ 'ਤੇ ਟੂਰਿਸਟ ਪਲੇਸਿਸ 'ਤੇ ਘੁੰਮਣ ਲਈ ਜਾਂਦੇ ਹਾਂ ਤਾਂ ਉੱਥੇ ਜਾ ਕੇ ਉਹਨਾਂ ਦੇ ਉੱਥੇ ਅਸੀਂ ਖਾਣ ਦੇ ਪੀਣ ਲਈ ਖਰਚਾ ਕਰਦੇ ਹਾਂ ਘੁੰਮਣ ਫਿਰਨ ਲਈ ਖਰਚਾ ਕਰਦੇ ਹਾਂ ਰਹਿਣ ਲਈ ਖਰਚਾ ਕਰਦੇ ਹਾਂ ਅਤੇ ਉਸ ਦੇ ਨਾਲ ਉਹਨਾਂ ਦੀ ਅਰਥ ਵਿਵਸਥਾ ਵੱਧਦੀ ਹੈ ਅਤੇ ਉਹਨਾਂ ਦੀ ਇਕਨੋਮਿਕ ਫ ਵੱਧਦੀ ਹੈ